ਸੱਭਿਆਚਾਰਕ ਖੇਤਰ ਦੇ ਵਿੱਚ ਕੁਛ ਸ਼ੈਲੀਆਂ ਨੇ ਜਿਹੜੀਆਂ ਉਹ ਅੱਜ ਵੀ ਅਸੀਂ ਦੇਖ ਸਕਦੇ ਹਾਂ ਜਿਵੇਂ ਕਿ ਜੇ ਨਾਚ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਲੋਕ ਨਾਚ ਗਿੱਧਾ ਭੰਗੜਾ ਹੈ ਜਿਹੜਾ ਉਹ ਅੱਜ ਵੀ ਜਿਹੜੀ ਨੱਚਿਆ ਜਾਂਦਾ ਹੈ ਕਿਉਂਕਿ ਜਿਹੜੇ ਲੋਕ ਨੇ ਉਹ ਪਰੰਪਰਾ ਤੋਂ ਇਹ ਨਾਚ ਨੱਚਦੇ ਆ ਰਹੇ ਨੇ ਅਤੇ ਪਿਛਲੀ ਪੀੜੀ ਅਗਲੀ ਪੀੜੀ ਨੂੰ ਇਹ ਨਾਚ ਹੈ ਜਿਹੜਾ ਉਹ ਵਿਰਸੇ ਦੇ ਵਿੱਚ ਹੀ ਸਿਖਾਉਂਦੀ ਹੈ ਜਿਵੇਂ ਕਿ ਵੱਖ ਵੱਖ ਖੁਸ਼ੀਆਂ ਦੇ ਮੌਕਿਆਂ ਦੇ ਉੱਤੇ ਇਹ ਨਾਚ ਨੱਚੇ ਜਾਂਦੇ ਨੇ ਤਾਂ ਸਹਿਜ ਸੁਭਾਵਿਕ ਹੀ ਹੈ ਕਿ ਇਹ ਨਾਚ ਨੇ ਜਿਹੜੇ ਅੱਜ ਵੀ ਕਾਇਮ ਨੇ ਇਸ ਤਰ੍ਹਾਂ ਇਹ ਨਾਚ ਨੇ ਜਿਹੜੇ ਇਹ ਸਿੱਖੇ ਅਤੇ ਸਿਖਾਏ ਜਾਂਦੇ ਹਨ